ਦੋਸਤ ਨੇ ਗਲਤੀ ਨਾਲ ਆਪਣੇ ਜੁੜਵਾ ਬੱਚਿਆਂ ਨੂੰ ਡੁਪਲੀਕੇਟ ਜਨਮ ਰਜਿਸਟ੍ਰੇਸ਼ਨ ਅਰਜ਼ੀਆਂ ਜਮ੍ਹਾਂ ਕਰ ਦਿੱਤੀਆਂ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਰੱਦ ਕਰਨ ਦੀ ਜ਼ਰੂਰਤ ਹੈ ਤੁਸੀਂ ਆਪਣੇ ਦੋਸਤ ਨਾਲ ਗੱਲ ਕਰਦੇ ਹੋ ਤਾਂ ਗੱਲ ਕਰਦੇ ਹਾਂ ਤਾਂ ਡੁਪਲੀਕੇਟ ਜਨਮ ਰਜਿਸਟ੍ਰੇਸ਼ਨ ਕ ਅਰਜ਼ੀਆਂ ਵਿੱਚੋਂ ਇੱਕ ਨੂੰ ਰੱਦ ਕਰਨ ਵਿੱਚ ਅਸੀਂ ਇਸ ਤਰ੍ਹਾਂ ਸਹਾਇਤਾ ਕਰਾਵਾਂਗੇ ਪਹਿਲਾਂ ਉਹਨੂੰ ਕਹਾਂਗੇ ਕਿ ਸੁਵਿਧਾ ਕੇਂਦਰ ਚੱਲੋ ਸੁਵਿਧਾ ਕੇਂਦਰ ਜਾ ਕੇ ਉੱਥੇ ਆਪਣੇ ਬੱਚਿਆਂ ਦੇ ਸਾਰੇ ਕਾਗਜ਼ ਪੱਤਰ ਜਮ੍ਹਾਂ ਕਰਵਾਓ ਅਤੇ ਫਿਰ ਉੱਥੇ ਐਪਲੀਕੈਸ਼ਨ ਜਮ੍ਹਾਂ ਕਰਵਾਓ ਫਿਰ ਉਹ ਅੱਗੇ ਜਾ ਕੇ ਰਜਿਸਟ ਰਜਿਸਟਰ ਆਫ਼ਿਸ ਜਾਣਗੇ ਫਿਰ ਉੱਥੋਂ ਜਾ ਕੇ ਸਾਰਾ ਕੁਛ ਜਿਵੇਂ ਜਿਵੇਂ ਉਹ ਕਹਿਣਗੇ ਉੱਦਾਂ ਕਰਨਾ ਪੈਣਾ ਹੈ ਉਨ੍ਹਾਂ ਨੂੰ ਭਰੋਸਾ ਦਿਖਾਇਆ ਜਾਂਦਾ ਹੈ ਕਿ ਫਿਰ ਭਵਿੱਖ ਵਿੱਚ ਪੇਚੀਦਗੀਆਂ ਤੋਂ ਤੁਸੀਂ ਬਚ ਸਕਦੇ ਹੋ